ਮੈਂ ਦੱਸਣਾ ਚਾਹੁੰਦਾ ਹਾਂ ਮੇਰੀ ਪੰਜਾਬੀ ਖੇਡ ਕਬੱਡੀ ਹੈ ਕਬੱਡੀ ਸਾਡੇ ਪੰਜਾਬ ਦੀ ਸ਼ਾਨ ਹੈ ਕਬੱਡੀ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਸ਼ਾਨ ਹੈ ਕਬੱਡੀ ਕਬੱਡੀ ਵਿੱਚ ਵਧੀਆ ਹੁੰਦੇ ਆ ਖੇਡਦੇ ਹਨ ਕਬੱਡੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਕਬੱਡੀ ਸਾਰੇ ਖੇਤਰਾਂ ਵਿੱਚ ਵਧੀਆ ਖੇਡ ਹੈ ਤਾਂ ਜੋ ਕਿ ਪੰਜਾਬੀਆਂ ਤੋਂ ਨਸ਼ੇ ਨੂੰ ਬਚਾਇਆ ਜਾ ਸਕੇ ਕਬੱਡੀ ਵਿੱਚ ਇਹੋ ਜਿਹੇ ਖਿਡਾਰੀ ਹਨ ਜੋ ਵਧੀਆ ਖੇਡਦੇ ਹਨ ਕਬੱਡੀ ਮਾਂ ਕਬੱਡੀ ਵਿੱਚ ਸੱਤ ਖਿਡਾਰੀ ਖੇਡਦੇ ਹਨ ਅੱਡੋ ਅੱਡ ਭਾਰ ਵਿੱਚ ਕਬੱਡੀ ਖੇਡੀ ਜਾਂਦੀ ਹੈ ਜਿਵੇਂ ਕਿ ਪਚਵੰਜਾ ਕਿਲੋ ਸੱਠ ਕਿਲੋ ਪੈਂਹਠ ਕਿਲੋ ਬਹੱਤਰ ਕਿਲੋ ਪਚਾਸੀ ਕਿਲੋ ਦੇ ਓਪਨ ਦੇ ਮੈਚ ਹੁੰਦੇ ਹਨ ਕਬੱਡੀ ਵਿੱਚ ਵੱਖ ਵੱਖ ਖਿਡਾਰੀਆਂ ਵੱਲੋਂ ਮੱਲਾਂ ਮਾਰੀਆਂ ਜਾਂਦੀਆਂ ਹਨ ਤਾਂ ਜੋ ਕਿ ਕਬੱਡੀ ਨੂੰ ਉੱਚਾ ਚੱਕਿਆ ਜਾ ਸਕੇ ਪੰਜਾਬ ਵਿੱਚ ਅਜਿਹੇ ਟੂਰਨਾਮੈਂਟ ਹੁੰਦੇ ਹਨ ਜਿਸ ਵਿੱਚ ਲੱਖਾਂ ਲੱਖਾਂ ਲੱਖਾਂ ਲੋਕ ਦੇਖਦੇ ਹਨ ਅਤੇ ਵਧੀਆ ਖਿਡਾਰੀ ਅੱਡੋ ਅੱਡ ਟੀਮਾਂ ਬਣਾ ਕੇ ਆਉਂਦੇ ਹਨ ਸ ਸਾਡੇ ਪਿੰਡ ਵੀ ਟੂਰਨਾਮੈਂਟ ਹੋਏ ਸੀ ਉਸ ਵਿੱਚ ਪ ਕਬੱਡੀ ਦੇ ਵਧੀਆ ਵਧੀਆ ਖਿਡਾਰੀ ਪਹੁੰਚੇ ਸਨ ਜਿਹਨਾਂ ਵੱਲੋਂ ਵਧੀਆ ਕਬੱਡੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਕਬੱਡੀ ਮਾਂ ਬੋਲੀ ਨੂੰ ਉੱਚਾ ਚੱਕਿਆ ਜਾਂਦਾ ਹੈ ਕਬੱਡੀ ਇੱਕ ਅਜਿਹੀ ਖੇਡ ਹੈ ਜਿਸ ਨੂੰ ਸਾਰੀ ਦੁਨੀਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਕਿ ਨਾ ਕਿ ਪੰਜਾਬੀਆਂ ਵੱਲੋਂ ਪੂਰੇ ਹਿੰਦੁਸਤਾਨ ਵੱਲੋਂ ਕਬੱਡੀ ਨੂੰ ਪਸੰਦ ਕੀਤਾ ਜਾਂਦਾ ਹੈ ਕਬੱਡੀ ਸਾਡੇ ਪੰਜਾਬ ਦੀ ਸ਼ਾਨ ਹੈ ਕਬੱਡੀ ਦੇ ਇੱਕ ਅਜਿਹੀ ਖੇਡ ਹੈ ਜੋ ਹਰ ਇੱਕ ਖੇਤਰ ਵਿੱਚ ਮੱਲਾਂ ਮਾਰਦੀ ਹੈ ਬ ਨਾ ਕਿ ਪੰਜਾਬ ਵਿੱਚ ਪੂਰੇ ਹਿੰਦੁਸਤਾਨ ਵਿੱਚ ਕਬੱਡੀ ਨੇ ਮੱਲਾਂ ਮਾਰੀਆਂ ਹਨ ਪੰਜਾਬ ਵਿੱਚ ਸਾਡੇ ਜਿਹੇ ਕਬੱਡੀ ਦੇ ਖਿਡਾਰੀ ਹਨ ਜਿਹਨਾਂ ਨੇ ਹਿੰਦੁਸਤਾਨ ਨੇ ਪੂਰੇ ਹੋਰਨਾਂ ਵੀ ਸਟੇਟਾਂ ਵਿੱਚ ਕਬੱਡੀ ਵਿੱਚ ਮੱਲਾਂ ਮਾਰੀਆਂ ਹਨ ਤਾਂ ਕਿ ਤਾਂ ਜੋ ਪੰਜਾਬੀ ਖੇਡ ਨੂੰ ਉੱਚਾ ਚ ਉੱਚਾ ਉੱਚਾ ਚੱਕਿਆ ਜਾਵੇ ਕਬੱਡੀ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਕਿਉਂਕਿ ਉਸ ਉਸ ਖੇਤਰਾਂ ਵਿੱਚ ਕਬੱਡੀ ਦੇ ਖਿਡਾਰੀ ਜ਼ਿਆਦਾ ਹੁਣ ਇਹ ਹੁਣ ਅੱਗੇ ਪੇਂਡੂ ਖੇਤਰਾਂ 'ਚ ਕਬੱਡੀ ਪਾਈ ਜਾਂਦੀ ਹੁਣ ਸ਼ਹਿਰਾਂ ਵਿੱਚ ਵੀ ਕਬੱਡੀ ਦਾ ਮਾਹੌਲ ਬਣ ਚੁੱਕਿਆ ਹੈ ਲੋਕ ਸਾਡੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਲਈ ਕਬੱਡੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਇਹ ਖੇਡ ਕੱਢਿਆ ਜੀ ਵਧੀਆ ਕਬੱਡੀ ਦੀ ਖੇਡ ਖੇਡਦੇ ਹਨ ਤਾਂ ਜੋ ਕਿ ਕਬੱਡੀ ਤੁਹਾਡੀ ਕਬੱਡੀ ਨਾਲ ਪੰਜਾਬ ਦੇ ਹਿੰਦ ਹੋਰਨਾਂ ਸੂਬਿਆਂ ਦਾ ਸਿਰ ਉੱਚਾ ਹੋ ਉੱਚਾ ਹੋ ਸਕੇ ਕਬੱਡੀ ਦੇ ਨਾਲ ਨਾਲ ਹੋਰ ਕਈ ਵੀ ਖੇਡਾਂ ਹਨ ਪਰ ਜ਼ਿਆਦਾ ਸਾਡੀ ਮਨ ਪਸੰਦ ਖੇਡ ਕਬੱਡੀ ਹੈ ਕਬੱਡੀ ਪੰਜਾਬੀਆਂ ਦੀ ਖੇਡ ਹੈ ਕਬੱਡੀ ਕਬੱਡੀ ਵਿੱਚ ਹੋਰ ਬਹੁਤ ਸਾਰੇ ਟੀਮਾਂ ਭਾਗ ਲੈਂਦੀਆਂ ਹਨ ਤਾਂ ਕੋਈ ਵੀ ਤਾਂ ਜੋ ਕੋਈ ਕਬੱਡੀ ਨੂੰ ਜਿੱਤ ਸਕੇ ਕਬੱਡੀ ਦੇ ਓਪਨ ਮੁਕਾਬਲੇ ਹੁੰਦੇ ਹਨ ਜਿਸ ਵਿੱਚ ਕਬੱਡੀ ਦਾ ਨਾਮ ਲੱਖਾਂ ਰੁਪਈਆਂ ਵਿੱਚ ਹੁੰਦਾ ਹੈ ਉਸ ਵਿੱਚ ਕਈ ਟੀਮਾਂ ਭਾਗ ਲੈਂਦੀਆਂ ਹਨ ਤਾਂ ਜੋ ਕਿ ਕਬੱਡੀ ਨੂੰ ਜਿੱਤ ਸਕੇ ਅਤੇ ਅਤੇ ਪੂਰੇ ਨਾਲ ਪੂਰਾ ਰੋਸ਼ਨ ਕਰ ਸਕੇ ਕਬੱਡੀ ਕਬੱਡੀ ਤੋਂ ਬਿਨਾਂ ਕੁਝ ਵੀ ਨਹੀਂ ਹੈ ਪੰਜਾਬ 'ਚ ਕਬੱਡੀ ਕਿਉਂਕਿ ਕਬੱਡੀ ਸਾਡੇ ਪੰਜਾਬ ਦੀ ਖੇਡ ਸ਼ਾਨ ਹੈ ਕਬੱਡੀ ਨੂੰ ਅਸੀਂ ਜ਼ਿਆਦਾਤਰ ਪਸੰਦ ਕਰਦੇ ਹਾਂ ਕਿਉਂਕਿ ਸਾਡੇ ਦੇਸ਼ ਦੀ ਸ਼ਾਨ ਹੈ ਕਬੱਡੀ ਅਜਿਹੀ ਖੇਡ ਹੈ ਜਿਸ ਨੂੰ ਲੋਕ ਵੱਧ ਤੋਂ ਵੱਧ ਇਤਰਾਜ਼ ਵਿੱਚ ਦੇਖਣ ਆਉਂਦੇ ਹਨ ਤਾਂ ਜੋ ਕਿ ਉਹਨਾਂ ਨੂੰ ਪਸੰਦ ਕਰ ਸਕੀਏ ਕਬੱਡੀ ਤੋਂ ਬਿਨਾਂ ਸਾਡਾ ਇੱਥੇ ਪੰਜਾਬ ਵਿੱਚ ਹੋਰ ਹੋਰਨਾਂ ਖੇਡਾਂ ਨੂੰ ਵਧੀਆ ਖੇਡ ਹੈ ਤਾਂ ਜੋ ਕਿ ਪੰਜਾਬੀ ਮਾਂ ਬੋਲੀ ਦੀ ਪਹਿਲੀ ਖੇਡ ਹੈ ਕਬੱਡੀ ਸਾਡੀ ਜਿਸ ਨਾਲ ਪੂਰੇ ਹਿੰਦੁਸਤਾਨ ਪੂਰੇ ਹਿੰਦੁਸਤਾਨ ਦਾ ਦਾ ਉੱਚਾ ਹੋ ਸਕੇ ਕਬੱਡੀ ਤੋਂ ਬਿਨਾਂ ਪੰਜਾਬ ਵਿੱਚ ਹੋਰ ਕੋਈ ਖੇਡ ਨਹੀਂ ਖੇਡੀ ਜਾਂਦੀ ਕਿਉਂ ਕਿਉਂਕਿ ਪੰਜਾਬ ਕਬੱਡੀ ਹੀ ਸਾਡੇ ਦੇਸ਼ ਦੀ ਬੜਬੋਲੀ ਸ਼ਾਨ ਹੈ ਕਬੱਡੀ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਲੱਖਾਂ ਕਰੋੜਾਂ ਲੋਕ ਖੇਡ ਦੇਖਣ ਆਉਂਦੇ ਹਨ ਤਾਂ ਜੋ ਕਿ ਉਹ ਉਹਨਾਂ ਵੱਲੋਂ ਉਹਨਾਂ ਖਿਡਾਰੀਆਂ ਅਤੇ ਹੋਰਨਾਂ ਸੂਬਿਆਂ ਨੂੰ ਵੀ ਪਤਾ ਲੱਗ ਸਕੇ ਕਬੱਡੀ ਕਬੱਡੀ ਬਿਨਾਂ ਕੁਛ ਵੀ ਨਹੀਂ ਹੈ ਕਿਉਂਕਿ ਕਬੱਡੀ ਪੰਜਾਬੀਆਂ ਦੀ ਇੱਕੋ ਜਿਹੀ ਖੇਡ ਹੈ ਜਿਸ ਨਾਲ ਪੂਰੇ ਹਿੰਦੁਸਤਾਨ ਕੀ ਵਾਰਡ ਵਾਰਡ ਦੀ ਸ਼ਾਨ ਕਬੱਡੀ ਹੈ ਕਬੱਡੀ ਸਾਡੇ ਕਬੱਡੀ ਹੁਣ ਵਧੀਆ ਢੰਗ ਨਾਲ ਖੇਡੀ ਜਾਂਦੀ ਹੈ ਕਿਉਂਕਿ ਇਸ ਵਿੱਚ ਕੋਈ ਰੌਲਾ ਰੱਪਾ ਨਹੀਂ ਪੈਂਦਾ ਤਾਂ ਜੋ ਉਲਟਿਆ ਸਮੇਂ ਸਿਰ ਖੇੜਸਾ ਇਸ ਵਿੱਚ ਲੱਖਾਂ ਲੱਖਾਂ ਦੇ ਨਾਮ ਹੁੰਦੇ ਹਨ ਤਾਂ ਜੋ ਖਿਡਾਰੀ ਕਬੱਡੀ ਖੇਡ ਖੇਡ ਕੇ ਜਿੱਤ ਸਕਣ ਅਤੇ ਆਪਣਾ ਪੂਜਾ ਕਬੱਡੀ ਦੇ ਖਿਡਾਈ ਨਸ਼ਾ ਤੋਂ ਦੂਰ ਰਹਿਣ ਲਈ ਕਬੱਡੀ ਖੇਡਦੇ ਹਨ ਹੁਣ ਸਾਡੇ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਕਬੱਡੀ ਵੱਲੋਂ ਕਬੱਡੀ ਕੋਚਾਂ ਵੱਲੋਂ ਸਭ ਟੀਮਾਂ ਬਣਾਈਆਂ ਜਾਂਦੀਆਂ ਹਨ ਜੋ ਤਾਂ ਜੋ ਟੀਮਾਂ ਹੋਰਨਾਂ ਸੂਬਿਆਂ ਵਿੱਚ ਜਾ ਕੇ ਭਾਗ ਲੈ ਸਕਣ ਪੰਜਾਬ ਵਿੱਚ ਕਬੱਡੀ ਦੇ ਨਾਲ ਨਾਲ ਵੱਖ ਵੱਖ ਅਕੈਡਮੀਆਂ ਬਣਾਈਆਂ ਬਣਾਈਆਂ ਗਈਆਂ ਹਨ ਤਾਂ ਜੋ ਕਿ ਪੰਜਾਬ ਵਿੱਚ ਅਜਿਹੀ ਦਿੱਤੀ ਜਾਵੇ ਮੇਰੀ ਮਨਪਸਿੰਦ ਪਸੰਦ ਖੇਡ ਕਬੱਡੀ ਹੈ ਤਾਂ ਮੈਂ ਹੋਰਨਾਂ ਨੂੰ ਵੀ ਸਲਾਹ ਦਿੰਦਾ ਹਾਂ ਸਾਡੀ ਮਨਪਸੰਦ ਖੇਡ ਕਬੱਡੀ ਹੈ ਧੰਨਵਾਦ ਜੀ